ਮੈਂ ਵਰਿੰਦਰ ਕੁਮਾਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਅੱਜ ਮੈਂ ਤੁਹਾਨੂੰ ਪਿੱਠ ਦਰਦ ਦੇ ਘਰੇਲੂ ਨੁਕਤਿਆਂ ਬਾਰੇ ਜਾਣਕਾਰੀ ਦੇਵਾਂਗਾ ਜੋ ਸਾਨੂੰ ਸਾਡੇ ਪੂਰਵਜਾ ਤੋਂ ਪ੍ਰਾਪਤ ਹੁੰਦੇ ਹਨ ਘਰੇਲੂ ਨੁਕਤੇ ਉਹ ਨੁਕਤੇ ਹੁੰਦੇ ਹਨ ਜਿਨ੍ਹਾਂ ਸਾਡੇ ਪੀੜੀ ਦਰ ਪੀੜੀ ਸਾਡੇ ਤੱਕ ਪਹੁੰਚਦੇ ਹਨ ਉਹ ਨੁਕਤਿਆਂ ਲਈ ਸਾਨੂੰ ਜਿਹੜਾ ਆ ਡਾਕਟਰ ਤੋਂ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਉਹ ਅਸੀਂ ਆਮ ਆਪਣੇ ਘਰਾਂ ਵਿੱਚ ਉਹ ਨੁਕਤਿਆਂ ਨੂੰ ਵਰਤਦੇ ਹਾਂ ਅਤੇ ਉਹ ਵਰਤ ਕੇ ਇੱਕ ਦੂਜੇ ਨੂੰ ਆਪਾਂ ਦੱਸਦੇ ਹਾਂ ਉਹਨਾਂ ਬਾਰੇ ਜਾਣਕਾਰੀ ਦਿੰਦੇ ਹਾਂ ਪਿੱਠ ਦਰਦ ਬਾਰੇ ਸਭ ਤੋਂ ਪਹਿਲਾ ਘਰੇਲੂ ਨੁਕਤਾ ਗਰਮ ਤੇਲ ਕਰਕੇ ਪੀੜਿਤ ਵਿਅਕਤੀ ਦੇ ਮਾਲਸ਼ ਕਰਨੀ ਜਦੋਂ ਕੋਈ ਵਿਅਕਤੀ ਪਿੱਠ ਦਰਦ ਨਾਲ ਪੀੜਿਤ ਹੁੰਦਾ ਹੈ ਤਾਂ ਆਪਾਂ ਤਿਲਾਂ ਦੇ ਤੇਲ ਨੂੰ ਥੋੜ੍ਹਾ ਜਿਹਾ ਕੋਸਾ ਕਰਕੇ ਮਤਲਬ ਗਰਮ ਕਰਕੇ ਉਹ ਪੀੜਿਤ ਵਿਅਕਤੀ ਦੇ ਹੌਲੀ ਹੌਲੀ ਮਸਾਜ ਕਰਦੇ ਹਾਂ ਜਿਸ ਨਾਲ ਉਸ ਨੂੰ ਬਹੁਤ ਆਰਾਮ ਮਿਲਦਾ ਹੈ ਉਹ ਆਪਣੇ ਆਪ ਨੂੰ ਵਧ ਮਤਲਬ ਵੀ ਵਧੀਆ ਫੀਲ ਕਰਦਾ ਹੈ ਨੰਬਰ ਦੋ ਪੀੜਿਤ ਵਿਅਕਤੀ ਨੂੰ ਸੰਤੁਲਿਤ ਆ ਆਹਾਰ ਦੇਣਾ ਪੀੜਿਤ ਵਿਅਕਤੀ ਨੂੰ ਸੰਤੁਲਿਤ ਆਹਾਰ ਸੰਤੁਲਿਤ ਆਹਾਰ ਦੇਣਾ ਪੀੜਿਤ ਵਿਅਕਤੀ ਨੂੰ ਉਹ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ ਜਿਹੜੀ ਆਇਰਨ ਭਰਪੂਰ ਹੋਵੇ ਠੀਕ ਹੈ ਕੈਲਸ਼ੀਅਮ ਭਰਪੂਰ ਹੋਵੇ ਉਹ ਖੁਰਾਕ ਜਿਹੜੀ ਆ ਦਿੱਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਫ਼ੈਟ ਹੋਵੇ ਫ਼ੈਟ ਦੀ ਮਾਤਰਾ ਵੱਧ ਹੋਵੇ ਜਿੰਨੀ ਪੀੜਿਤ ਵਿਅਕਤੀ ਨੂੰ ਪਿੱਠ ਦਰਦ ਨਾਲ ਪੀੜਿਤ ਵਿਅਕਤੀ ਨੂੰ ਫ਼ੈਟ ਚਰਬੀ ਵਾਲੀਆਂ ਚੀਜ਼ਾਂ ਜਾਂ ਗਰਮ ਚੀਜ਼ਾਂ ਦਿੱਤੀਆਂ ਜਾਣਗੀਆਂ ਓਨਾ ਹੀ ਵਿਅਕਤੀ ਨੂੰ ਜਿਹੜਾ ਅਸਰ ਵਧੀਆ ਹਾਸਲ ਹੋਵੇਗਾ ਥੈਂਕ ਯੂ